ਜੋ ਮੇਰੀ ਪਸੰਦੀਦਾ ਸ਼ੈਲੀ ਹੈ ਉਹ ਹੈ ਬਿਜਨਸ ਮੈਨੂੰ ਬਿਜਨਸ ਕਰਨ ਦੇ ਵਿੱਚ ਬਹੁਤ ਹੀ ਇੰਟਰਸਟ ਹੈ ਮੇਰੇ ਫਾਦਰ ਵੀ ਇੱਕ ਸਕਸੈਸਫੁਲ ਬਿਜ਼ਨਸਮੈਨ ਨੇ ਤੇ ਮੇਰਾ ਬ੍ਰਦਰ ਵੀ ਉਹਨਾਂ ਨੂੰ ਹੀ ਫੋਲੋ ਕਰ ਰਿਹਾ ਅਤੇ ਮੈਂ ਵੀ ਇਨ ਫਿਊਚਰ ਆਪਣੇ ਬ੍ਰਦਰ ਅਤੇ ਫਾਦਰ ਨੂੰ ਸਪੋਰਟ ਕਰਨਾ ਚਾਹੁੰਦੀ ਹਾਂ ਅਤੇ ਮੈਂ ਉਹਨਾਂ ਦੇ ਬਿਜਨਸ ਨੂੰ ਇੱਕ ਐਕਸਟੈਂਟ ਲੈਵਲ ਤੱਕ ਲੈ ਕੇ ਜਾਣਾ ਚਾਹੁੰਦੀ ਮੈਂ ਚਾਹੁੰਦੀ ਹਾਂ ਕਿ ਕੁੜੀਆਂ ਨੂੰ ਵੀ ਇਮਪਲੋਇਮੈਂਟ ਮਿਲੇ ਸੋ ਮੈਂ ਇਸ ਤਰ੍ਹਾਂ ਦਾ ਬਿਜ਼ਨਸ ਕਰਨਾ ਚਾਹੁੰਦੀ ਹਾਂ ਅਤੇ ਕੁੜੀਆਂ ਨੂੰ ਵੀ ਅੱਗੇ ਤੱਕ ਲੈ ਕੇ ਜਾਣਾ ਚਾਹੁੰਦੀ ਹਾਂ ਕਿਉਂਕਿ ਅਜੇ ਵੀ ਭਾਰਤ ਵਿੱਚ ਕੁੜੀਆਂ ਅਤੇ ਮੁੰਡਿਆਂ ਵਿੱਚ ਬਹੁਤ ਹੀ ਫਰਕ ਹੈ ਕੁੜੀਆਂ ਆਪਣੇ ਆਪ ਨੂੰ ਅਜੇ ਵੀ ਅੱਗੇ ਤੱਕ ਪੇਸ਼ ਨਹੀਂ ਕਰ ਪਾਉਂਦੀਆਂ ਇਸ ਲਈ ਮੈਂ ਵੂਮਨ ਐਮਪਾਵਰਮੈਂਟ ਦੇ ਬੇਸਿਸ 'ਤੇ ਉਹਨਾਂ ਨੂੰ ਵੀ ਇੰਪਲੋਮੈਂਟ ਦਵਾਓਗੇ ਅਤੇ ਵੱਧ ਤੋਂ ਵੱਧ ਉਹਨਾਂ ਨੂੰ ਇੰਪਲੋਮੈਂਟ ਦਵਾਉਣ ਦੀ ਕੋਸ਼ਿਸ਼ ਕਰੂੰਗੀ ਤਾਂ ਕਿ ਉਹ ਵੀ ਆਪਣੇ ਆਪ ਨੂੰ ਘੱਟ ਨਾ ਸਮਝ ਸਕੇ ਇਸ ਲਈ ਮੈਂ ਬਿਜ਼ਨਸ ਕਰਨਾ ਚਾਹੁੰਦੀ ਹਾਂ ਅਤੇ ਉਸ ਦੇ ਰਿਲੇਟਿਡ ਹੀ ਬੁੱਕਸ ਇਨ ਫਿਊਚਰ ਪੜ੍ਹਨਾ ਚਾਹੂੰਗੀ ਅਤੇ ਜਿਹੜੀ ਬੁੱਕ ਮੈਂ ਹਾਲ ਹੀ ਵਿੱਚ ਪੜ੍ਹੀ ਹੈ ਉਸਦਾ ਨਾਮ ਹੈ ਹਾਓ ਟੂ ਡੂ ਬਿਜਨਸ ਇਨ ਐਨ ਐਫੀਸ਼ੀਐਂਟ ਵੇ ਸੋ ਇਸ ਬੁੱਕ ਵਿੱਚ ਮੈਨੂੰ ਪਤਾ ਲੱਗਾ ਕਿ ਅਸੀਂ ਕਿਵੇਂ ਬਿਜਨਸ ਕਰ ਸਕਦੇ